ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਡਮ ਓਕੇ ਮੈਡਮ ਠੀਕ ਹੈ ਮੈਡਮ ਹਾਂਜੀ ਹਾਂਜੀ ਮਿਲਜਾਊ ਜੀ ਹਾਂਜੀ ਲੱਡੂ ਲੱਡੂ ਗੁਲਾਬ ਜਾਮਣਾ ਜੀ ਬਰਫੀ ਵਗੈਰਾ ਹੋਰ ਜੀ ਗਜਰੇਲਾ ਵੀ ਮਿਲ ਜਾਊ ਜੀ ਹਾਂਜੀ ਹਾਂਜੀ ਬਰਫੀ ਵੀ ਹਾਂਜੀ ਹਾਂਜੀ ਓਕੇ ਜੀ ਹਾਂਜੀ ਹਾਂਜੀ ਮਿਲ ਜਾਊ ਜੀ ਓਕੇ ਜੀ ਲੱਡੂ ਲੱਡੂ ਹੋ ਗਏ ਜੀ ਆਪਣੇ ਬਰਫੀ ਹੋ ਗਈ ਗੁਲਾਬ ਜਾਮਣਾ ਹੋ ਗਈਆਂ ਜੀ ਅਤੇ ਹੋਰ ਜੀ ਹੋਰ ਹਾਂਜੀ ਹਾਂਜੀ ਰਸਗੁੱਲੇ ਹੋ ਗਏ ਗਜਰੇਲਾ ਹੋ ਗਿਆ ਜੀ ਖੋਆ ਵਗੈਰਾ ਜੀ ਹਾਂਜੀ ਹੋਰ ਜੀ ਹਾਂਜੀ ਹਾਂਜੀ ਆਪਣਾ ਨਾ ਜੀ ਬਰਨਾਲਾ ਚੋ ਨੂਰ ਚੌਂਕ ਕੋਲ ਦੁਕਾਨ ਆ ਜੀ ਸਵੀਟ ਚੰਦਨ ਦੀ ਦੁਕਾਨ ਆ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਜੀ ਹਾਂਜੀ ਹਾਂਜੀ ਜ਼ਰੂਰ ਜੀ ਆਪਣੇ ਜਿਹਨੂੰ ਮਰਜ਼ੀ ਪੁੱਛ ਲਿਓ ਇੱਕ ਨੰਬਰ ਮਿਠਿਆਈ ਹੋਊ ਜੀ ਆਪਣੀ ਸਾਰੀ ਕੋਈ ਮਿਲਾਵਟ ਨਹੀਂ ਹੋਊ ਜੀ ਕਿਸੇ ਵੀ ਚੀਜ਼ ਦੀ ਹਾਂਜੀ ਬਿਲਕੁਲ ਫ੍ਰੈਸ਼ ਫ੍ਰੈਸ਼ ਸਮਾਨ ਮਿਲੂਗਾ ਜੀ ਤੁਹਾਨੂੰ ਤਾਜ਼ਾ ਹਾਂਜੀ ਹਾਂਜੀ ਜਦੋਂ ਤੁਸੀਂ ਕਹੋਗੇ ਉਦੋਂ ਆਪਾਂ ਸਮਾਨ ਜੀ ਬਿਲਕੁਲ ਤਾਜ਼ਾ ਬਣਾ ਕੇ ਇੱਕ ਨੰਬਰ ਕੁਆਲਟੀ ਦੀ ਦੇਵਾਂਗੇ ਜੀ ਓਕੇ ਮੈਡਮ ਓਕੇ ਜੀ